ਇੱਕ ਜਨਵਰੀ ਉੱਨੀ ਸੌ ਸਤਾਨਵੇਂ ਦਸ ਮਾਰਚ ਉੱਨੀ ਸੌ ਛਿਆਨਵੇਂ ਅਠਾਰਾਂ ਜਨਵਰੀ ਦੋ ਹਜ਼ਾਰ ਚਾਰ ਛੇ ਜੂਨ ਉੱਨੀ ਸੌ ਚੁਰਾਸੀ ਛੱਬੀ ਅਗਸਤ ਦੋ ਹਜ਼ਾਰ